ਦੇਖੋ ਜੀ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਏ ਜੀ ਅੱਜ ਕੱਲ੍ਹ ਦੁਨੀਆ ਬਹੁਤ ਹੀ ਬਦਲ ਰਹੀ ਹੈ ਜੀ ਜਿਸ ਨਾਲ਼ ਕਿ ਲੋਕਾਂ ਦਾ ਮਨੋਬਲ ਬਹੁਤ ਹੀ ਉੱਪਰ ਜਾ ਰਿਹਾ ਹੈ ਅਤੇ ਕੁਛ ਕੁ ਵਿੱਚ ਉਹ ਵੀ ਲੋਕ ਨੇ ਜੋ ਕਿ ਨੈਗੇਟਿਵ ਤਰੀਕੇ ਨਾਲ਼ ਆਪਣੇ ਆਪ ਨੂੰ ਡੀਮੋਟੀਵੇਟ ਵੀ ਕਰਦੇ ਨੇ ਜਿਵੇ ਕਿ ਦੁਨੀਆ ਦੇ ਬਦਲਣ ਨਾਲ਼ ਜੀ ਬਹੁਤ ਹੀ ਚੀਜ਼ਾਂ ਬਦਲ ਰਹੀਆਂ ਜਿਵੇਂ ਕਿ ਦਿਨ ਪਰ ਦਿਨ ਟਕਨੋਲਜੀ ਵੱਧ ਰਹੀ ਹੈ ਜੀ ਅੱਜ ਕੱਲ੍ਹ ਮੋਬਾਇਲ ਫੋਨ ਹੋ ਗਏ ਅੱਜ ਤੋਂ ਆਪਾਂ ਪੰਜਾਹ ਸਾਲ ਪਹਿਲਾਂ ਚੱਲੀਏ ਨਾ ਤਾਂ ਫੋਨ ਹੁੰਦੇ ਤੇ ਅਤੇ ਨਾ ਹੀ ਸਿਗਨਲ ਵਗੈਰਾ ਕੁਛ ਵੀ ਹੁੰਦਾ ਤਾ ਅਤੇ ਉਦੋਂ ਜਦ ਕਿ ਲੈਟ ਵੀ ਨਹੀਂ ਹੁੰਦੀ ਸੀ ਹੁਣ ਸਾਨੂੰ ਇਹ ਵੀ ਫੈਸਿਲਟੀਆਂ ਬਹੁਤ ਹੋ ਗਈਆਂ ਜਿਵੇਂ ਕਿ ਲੈਟ ਘਰਾਂ 'ਚ ਪ੍ਰੋਵਾਇਡ ਕਰਵਾ ਤੀ ਉਹਨਾਂ ਨੇ ਹਰ ਇੱਕ ਪਿੰਡ 'ਚ ਪੰਜਾਬ ਦੇ 'ਚ ਅਤੇ ਪਛੜੇ ਵੇ ਇਲਾਕਿਆਂ ਤੱਕਰ ਉਹਨਾਂ ਨੇ ਬਿਜਲੀ ਦੀ ਪਹੁੰਚਾਤੀ ਸਾਰੇ ਕਿਤੇ ਅਤੇ ਨੰਬਰ ਦੋ 'ਤੇ ਸਾਡੇ ਜਿੱਦਾਂ ਕਹਿ ਲਉ ਨੈੱਟਵਰਕਾਂ ਲਈ ਟਾਵਰ ਵਗੈਰਾ ਹੋ ਗਏ ਅਤੇ ਸੜਕਾਂ ਹੋ ਗਈਆਂ ਅਤੇ ਮਤਲਬ ਰਹਿਣ ਸਹਿਣ ਲਈ ਵਧੀਆ ਘਰ ਹੋ ਗਏ ਅਤੇ ਸਾਡੇ ਕੋਲ਼ ਮਤਲਬ ਬੀਮਾਰੀ ਤੋਂ ਨਜਿੱਠਣ ਵਾਸਤੇ ਗੌਰਮਿੰਟ ਨੇ ਬਹੁਤ ਹੀ ਵਧੀਆ ਹੋਸਪੀਟਲ ਵੀ ਦਏ ਹੋਏ ਆਂ ਜੋ ਕਿ ਸਾਡੇ ਲਈ ਬਹੁਤ ਬੈਨੀਫਿੱਟ ਰੱਖਦੇ ਹੈ ਜਿਵੇਂ ਕਿ ਸਾਡੇ ਜੇ ਕਿਸੇ ਨੂੰ ਕੋਈ ਫੀਵਰ ਵਗੈਰਾ ਜਾਂ ਕੋਈ ਵੀ ਮੇਜਰ ਇਸ਼ੂ ਵੀ ਆਉਂਦਾ ਹੈ ਤਾਂ ਅਸੀਂ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦੇ ਹਾਂ ਨਾ ਕਿ ਬਹੁਤੇ ਮਹਿੰਗੇ ਵੀ ਨਹੀਂ ਹੈਗੇ ਇਸ ਚੀਜ਼ ਨੂੰ ਹਰ ਕੋਈ ਅਫੋਡ ਕਰ ਸਕਦਾ ਹੈ ਐਵੇਂ ਨਹੀਂ ਵੀ ਕੋਈ ਗਰੀਬ ਬੰਦਾ ਉੱਥੇ ਜਾ ਨਹੀਂ ਸਕਦਾ ਇਹ ਗੌਰਮਿੰਟ ਦੇ ਸਭ ਤੋਂ ਵਧੀਆ ਉਪਰਾਲੇ ਹੈ ਜੀ ਅਤੇ ਆਉਣ ਵਾਲ਼ੇ ਟਾਇਮ 'ਚ ਇਸੇ ਤਰ੍ਹਾਂ ਦੇ ਨਾਲ਼ ਬਦਲਿਆ ਜਾਵੇ ਅਤੇ ਜੋ ਕਿ ਧੰਨਵਾਦ ਜੀ